ਸਤਿ ਸ਼੍ਰੀ ਅਕਾਲ ਜੀ ਸ਼ੌਕ ਤਾਂ ਮੈਨੂੰ ਬਾਹਲਾ ਹੈ ਜੀ ਸੰਗੀਤ ਦਾ ਅਤੇ ਗਾਉਣ ਦਾ ਅਤੇ ਗਾਇਕੀ ਦਾ ਲੇਕਿਨ ਮੈਂ ਕਦੇ ਆਪ ਮੇਰੀ ਇੰਨੀ ਵ ਅਵਾਜ਼ ਦੇ ਵਧੀਆ ਹੈ ਨਹੀਂ ਅਤੇ ਮੈਂ ਕਦੇ ਕੋਈ ਇੰਸਟਰੂਮੈਂਟ ਵੀ ਕਦੇ ਵਜਾਇਆ ਹੈ ਨਹੀਂ ਪਰ ਜੇ ਮੈਨੂੰ ਕਦੀ ਮੌਕਾ ਮਿਲੇ ਜਾਂ ਮੈਨੂੰ ਚਾਂਸ ਮਿਲੇ ਇਸ ਚੀਜ਼ ਦਾ ਕਿ ਮੈਂ ਉਹ ਕਰ ਸਕਾਂ ਤਾਂ ਮੈਂ ਇੱਕ ਤਾਂ ਪਿਆਨੋ ਹੋ ਗਿਆ ਜੀ ਇੱਕ ਸਿਤਾਰ ਹੋ ਗਿਆ ਇਹ ਦੋ ਜਿਹੜੇ ਮਿਊਜਿਕਲ ਇੰਸਟਰੂਮੈਂਟ ਹੈ ਸਾਧਨ ਹੈ ਜਿਹੜੇ ਗਾਉਣ ਵਾਲੇ ਵਜਾਉਣ ਵਾਲੇ ਇਹ ਮੈਨੂੰ ਵਧੀਆ ਲੱਗਦੇ ਆ ਅਤੇ ਇਹਨਾਂ ਦੀ ਇੱਕ ਤਾਂ ਜੀ ਇਹਨਾਂ ਦੀ ਧੁੰਨ ਜਿਹੜੀ ਬਣਦੀ ਹੈ ਅਤੇ ਉਹ ਅਤੇ ਇਹਨਾਂ ਦੀ ਟਿਊਨਿੰਗ ਇਹ ਮੈਨੂੰ ਬੜੀ ਪਿਆਰੀ ਲੱਗਦੀ ਹੈ ਜਿਹੜੇ ਜਿਹੜੇ ਗਾਣੇ ਦੇ ਵਿੱਚ ਇਹਨਾਂ ਦਾ ਯੂਜ ਹੁੰਦਾ ਸਿਤਾਰ ਦਾ ਅਤੇ ਪਿਆਨੋ ਦਾ ਉਹ ਉਹ ਉਹਨੂੰ ਸੁਣਨ ਸੁਣ ਕੇ ਇੱਕ ਅਲੱਗ ਹੀ ਮਜ਼ਾ ਆਉਂਦਾ ਜੀ ਅਤੇ ਬੜਾ ਮਤਲਬ ਦਿਲ ਨੂੰ ਸਕੂਨ ਮਿਲਦਾ ਅਤੇ ਵਧੀਆ ਲੱਗਦਾ ਅਤੇ ਮੈਨੂੰ ਕਦੇ ਮੌਕਾ ਮਿਲਿਆ ਤਾਂ ਮੈਂ ਸਿਤਾਰ ਅਤੇ ਪਿਆਨੋ ਜ਼ਰੂਰ ਸਿੱਖਣ ਦੀ ਕੋਸ਼ਿਸ਼ ਕਰੂੰਗਾ ਜੀ